ਸਾਡੇ ਖੇਤਰ ਵਿੱਚ ਮੁੱਖ ਸਿਆਸੀਆਂ ਪਾਰਟੀਆਂ ਅਤੇ ਉਹਨਾਂ ਦੇ ਵਿਕਾਸ ਦੀ ਇਤਿਹਾਸਿਕ ਪ੍ਰਕਿਰਿਆ ਦੀ ਗੱਲ ਕਰੀਏ ਤਾਂ ਕੁਝ ਮੁੱਖ ਪਾਰਟੀਆਂ ਇਹ ਹਨ ਸ਼੍ਰੋਮਣੀ ਅਕਾਲੀ ਦਲ ਗਠਨ ਉੱਨੀ ਸੌ ਵੀਹ ਦੇ ਦਹਾਕੇ ਵਿੱਚ ਸਿੱਖ ਸੱਭਿਆਚਾਰ ਅਤੇ ਧਾਰਮਿਕ ਹੱਕਾਂ ਦੀ ਰੱਖਿਆ ਲਈ ਇਸ ਪਾਰਟੀ ਦੀ ਸਥਾਪਨਾ ਹੋਈ ਉਦੇਸ਼ ਸਿੱਖਾਂ ਦੇ ਹੱਕਾਂ ਦੀ ਰੱਖਿਆ ਹੇਤਾਂ ਦੇ ਹਿੱਤਾਂ ਦੀ ਪਰਖੀ ਸਿਆਸਤ ਅਤੇ ਪੰਥਕ ਮਸਲੇ ਵਿਕਾਸ ਉੱਨੀ ਸੌ ਸੰਤਾਲੀ ਵਿੱਚ ਬਾਦਲ ਵਾਰੀ ਹ ਹਲਚਲ ਤੋਂ ਬਾਅਦ ਇਹ ਪਾਰਟੀ ਸਿੱਖ ਸਮਾਜ ਵਿੱਚ ਕਾਫ਼ੀ ਮਸ਼ਹੂਰ ਹੋਈ ਭਾਰਤੀ ਜਨਤਾ ਪਾਰਟੀ ਗਠਨ ਉੱਨੀ ਸੌ ਅੱਸੀ ਵਿੱਚ ਜਨਤਾ ਪਾਰਟੀ ਤੋਂ ਨਿਕਲ ਕੇ ਇਹ ਪਾਰਟੀ ਬਣੀ ਉਦੇਸ਼ ਸਮਾਜਿਕ ਅਤੇ ਆਰਥਿਕ ਵਿਕਾਸ ਦਾ ਸੁਧਾਰ ਅਤੇ ਰਾਸ਼ਟਰਵਾਦੀ ਅਧਾਰ 'ਤੇ ਸਿਆਸਤ ਦੇ ਵਿਕਾਸ ਉੱਨੀ ਸੌ ਨੱਬੇ ਦੇ ਦਹਾਕੇ ਵਿੱਚ ਬ ਪੰਜਾਬ ਵਿੱਚ ਮਜ਼ਬੂਤੀ ਪ੍ਰਾਪਤ ਕੀਤੀ ਕਾਂਗਰਸ ਪਾਰਟੀ ਗਠਨ ਉਨ ਅਠਾਰਾਂ ਸੌ ਪੱਚਾਸੀ ਵਿੱਚ ਬਣੀ ਅਤੇ ਬਾਅਦ ਵਿੱਚ ਇਸ ਨੇ ਪੰਜਾਬ ਵਿੱਚ ਖ਼ਾਸ ਧਿਆਨ ਦਿੱਤਾ ਉਦੇਸ਼